ਸਾਡੇ ਘਰ ਦਾ ਵਿਹੜਾ ਬਹੁਤ ਹੀ ਛੋਟਾ ਹੈ ਇਸ ਲਈ ਅਸੀਂ ਗਮਲਿਆਂ ਦੀ ਵਰਤੋਂ ਕਰਦੇ ਹਾਂ ਗਮਲਿਆਂ ਦੇ ਵਿੱਚ ਸੋਹਣੇ ਸੋਹਣੇ ਪੌਦੇ ਲਗਾਈ ਦੇ ਨੇ ਫੁੱਲਾਂ ਦੇ ਫਲਾਂ ਦੇ ਸਬਜ਼ੀਆਂ ਦੇ ਜਿਸ ਤਰ੍ਹਾਂ ਕੁਝ ਬੂਟੇ ਫੁੱਲਾਂ ਦੇ ਅਸੀਂ ਵੇਹੜੇ ਵਿੱਚ ਲਗਾ ਕੇ ਰੱਖੇ ਨੇ ਉਹਨਾਂ ਦੀ ਵਧੀਆ ਤਰ੍ਹਾਂ ਦੇਖਭਾਲ ਕਰੀਦੀ ਹੈ ਕੋਈ ਵੀ ਉਹਨਾਂ ਨੂੰ ਬਿਮਾਰੀ ਹੋਵੇ ਫਿਰ ਉਹਨਾਂ ਦੀ ਦੇਖਭਾਲ ਕਰੀ ਦੀ ਪਾਣੀ ਟਾਈਮ ਸਿਰ ਦਈਦਾ ਵਾ ਖਾਦ ਟਾਈਮ ਸਿਰ ਪਾਈਦੀ ਆ ਅਤੇ ਕੁਝ ਬੂਟੇ ਅਸੀਂ ਜਿਸ ਤਰ੍ਹਾਂ ਤੁਲਸੀ ਹੋਈ ਫਲਾਂ ਦੇ ਬੂਟੇ ਹੋਏ ਜਿਸ ਤਰ੍ਹਾਂ ਸਬਜ਼ੀਆਂ ਦੇ ਸਬਜ਼ੀਆਂ ਦੇ ਬੂਟੇ ਅਸੀਂ ਘਰਾਂ ਵਿੱਚ ਘਰ ਵਿੱਚ ਹੀ ਲਗਾ ਕੇ ਰੱਖੀਦੇ ਆ ਉਹਨਾਂ ਤੋਂ ਮੈਂ ਸਬਜ਼ੀਆਂ ਲੈਂਦੀ ਹਾਂ ਅਤੇ ਇਸ ਕਰਕੇ ਉਹਨਾਂ ਨੂੰ ਵੀ ਟਾਈਮ ਸਿਰ ਪਾਣੀ ਦੇਨੀ ਹਾਂ ਟਾਈਮ ਸਿਰ ਖਾਦ ਪਾਉਂਦੇ ਹਾਂ ਦੇਖਭਾਲ ਵਧੀਆ ਤਰ੍ਹਾਂ ਕਰਦੇ ਹਾਂ ਉਸਦੀ ਇਸ ਤਰ੍ਹਾਂ ਓਹ ਵੀ ਵਧੀਆ ਰਹਿੰਦੇ ਨੇ ਅਤੇ ਉਹਨਾਂ ਨੂੰ ਬੱਚਿਆਂ ਆਪਣੇ ਬੱਚਿਆਂ ਵਾਂਗ ਪਾਲਿਆ ਹੈ ਇਸ ਤਰ੍ਹਾਂ ਉਸਦੀ ਵਧੀਆ ਤਰ੍ਹਾਂ ਦੇਖਭਾਲ ਕਰੀਦੀ ਹੈ ਇਹ ਮੈਨੂੰ ਸ਼ੁਰੂ ਤੋਂ ਹੀ ਬਹੁਤ ਸ਼ੌਂਕ ਸੀ ਫੁੱਲ ਬੂਟੇ ਔਰ ਸਬਜ਼ੀਆਂ ਵਗੈਰਾ ਫਲਾਂ ਦੇ ਬੂਟੇ ਲਗਾਉਣੇੇ ਬੜਾ ਹੀ ਪਸੰਦ ਸੀ ਅਤੇ ਅਸੀਂ ਬਹੁਤ ਹੀ ਵਧੀਆ ਛੱਤ ਉੱਪਰ ਵੀ ਬਹੁਤ ਸੋਹਣੀ ਬਗੀਚੀ ਬਣਾਈ ਹੋਈ ਹੈ ਅਤੇ ਘਰ ਦੇ ਵਿਹੜੇ ਵਿੱਚ ਵੀ ਛੋਟੀ ਜਿਹੀ ਬਗੀਚੀ ਬਣਾਈ ਹੋਈ ਹੈ